ਅਸੀਂ ਪੌਦੇ ਉਗਾਉਣ ਲਈ ਮਿੱਟੀ ਨੂੰ ਤਿਆਰ ਕਰਦੇ ਹਾਂ ਮਿੱਟੀ ਵਿੱਚ ਕੁਝ ਖਾਦ ਅਤੇ ਉਸ ਵਿੱਚ ਰੇਤਲੀ ਮਿੱਟੀ ਦਾ ਕੁਝ ਪ੍ਰਤੀਸ਼ਤ ਮਿਲਾ ਕੇ ਉਸ ਨੂੰ ਖੁਰਪੇ ਦੀ ਮਦਦ ਨਾਲ ਗੱਡ ਲਿਆ ਜਾਂਦਾ ਹੈ ਫਿਰ ਉਸ ਮਿੱਟੀ ਵਿੱਚ ਖਾਦ ਨੂੰ ਚੰਗੀ ਤਰ੍ਹਾਂ ਧੁਰ ਮਿਲਾ ਲਿਆ ਜਾਂਦਾ ਹੈ ਫਿਰ ਉਸ ਮਿੱਟੀ ਨੂੰ ਕਿਸੇ ਗਮਲੇ ਵਿੱਚ ਪਾ ਲੈਂਦੇ ਹਾਂ ਜਾਂ ਫਿਰ ਜ਼ਮੀਨ ਵਿੱਚ ਹੀ ਗੋਲ ਜਗ੍ਹਾ ਬਣਾ ਕੇ ਉਸ ਵਿੱਚ ਪਹਿਲਾ ਪੌਦਾ ਲਗਾ ਦਿੱਤਾ ਜਾਂਦਾ ਹੈ ਫਿਰ ਉਸ ਵਿੱਚ ਹਲਕਾ ਹਲਕਾ ਪਾਣੀ ਦਾ ਛਿੜਕਾਅ ਤ ਕੀਤਾ ਜਾਂਦਾ ਹੈ ਫਿਰ ਉਸ ਦਿਨ ਪੌਦੇ ਨੂੰ ਹਲਕਾ ਹਲਕਾ ਪਾਣੀ ਵੀ ਲਗਾਇਆ ਜਾਂਦਾ ਹੈ ਅਤੇ ਨਾਲ ਖਾਦ ਵੀ ਪਾਈ ਜਾਂਦੀ ਹੈ ਜਦੋਂ ਪੌਦਾ ਕੁਝ ਵੱਡਾ ਹੋ ਜਾਂਦਾ ਹੈ ਉਸ ਦੇ ਹਿਸਾਬ ਨਾਲ ਪਾਣੀ ਦਿੱਤਾ ਜਾਂਦਾ ਹੈ